ਮੈਂ ਪਟਿਆਲਾ ਨੇੜੇ ਇੱਕ ਪਿੰਡ 'ਚ ਰਹਿੰਦੀ ਹਾਂ ਜਿੱਥੇ ਸਭ ਤੋਂ ਨੇੜੇ ਸ਼ਿਵਾਲਿਕ ਮਾਊਂਨਟੇਨ ਦੀ ਰੇਂਜ ਹੈ ਜੋ ਪਾਈ ਜਾਂਦੀ ਹੈ ਸੋ ਇਹ ਵਾਲੇ ਜੋ ਮਾਊਂਟੇਨਸ ਹੈ ਹਿਮਾਲਿਆ ਮਾਊਂਟੇਨਸ ਦੀ ਇੱਕ ਰੇਂਜ ਹੈ ਜਿੱਥੇ ਕਿ ਬਹੁਤ ਸਾਰੇ ਲੋਕ ਹੈ ਜੋ ਘੁੰਮਣਾ ਪਸੰਦ ਕਰਦੇ ਜਿਹਦੇ ਵਿੱਚੋਂ ਬਹੁਤ ਹੀ ਫੇਮਸ ਜੋ ਹਿਲ ਸਟੇਸ਼ਨ ਹੈ ਉਹਦਾ ਨਾਮ ਕਸੌਲੀ ਹੈ ਜਿੱਥੇ ਮੋਸਟਲੀ ਗਰਮੀਆਂ ਦੇ ਵਿੱਚ ਲੋਕ ਜਾਣਾ ਪਸੰਦ ਕਰਦੇ ਹਨ ਔਰ ਇਸ ਜਗ੍ਹਾ 'ਤੇ ਲੋਕੀ ਬਾਏ ਕਾਰ ਔਰ ਬਾਏ ਟਰੇਨ ਦੋਨੋਂ ਤਰ੍ਹਾਂ ਨਾਲ ਜਾ ਸਕਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਡਿਸਟੈਂਸ ਨਹੀਂ ਹੈ ਨੀਅਰ ਅਬਾਊਟ ਟ ਫਿਫਟੀ ਕੁ ਕਿਲੋਮੀਟਰ ਦਾ ਹੀ ਫ਼ਾਸਲਾ ਹੈ ਸੋ ਜਿਹਦੇ ਨਾਲ ਕੀ ਆ ਲੋਕੀਂ ਉੱਥੇ ਜਾ ਕੇ ਘੁੰਮ ਫਿਰ ਕੇ ਵਾਪਸ ਆ ਸਕਦੇ ਹਨ ਇਸ ਤੋਂ ਇਲਾਵਾ ਮੇਰੇ ਏਰੀਏ ਦੇ ਵਿੱਚ ਕਈ ਸ਼ੀਸ਼ਮ ਦੇ ਪੇੜ ਪਾਏ ਜਾਂਦੇ ਆ ਨਾ ਸ਼ੀਸ਼ਮ ਕਿਉਂਕਿ ਪੰਜਾਬ ਦਾ ਇੱਕ ਰਾਜ ਰੁੱਖ ਹੈ ਰਾਜ ਪੱਧਰੀ ਰੁੱਖ ਜਿਹਨੂੰ ਡਿਕਲੇਅਰ ਕੀਤਾ ਗਿਆ ਸੋ ਐਵੇਂ ਦੇ ਰੁੱਖ ਪਾਏ ਜਾਂਦੇ ਹਨ ਅਤੇ ਕਈ ਜਾਨਵਰ ਜੋ ਕਿ ਡੋਮੈਸਟਿਕ ਐਨੀਮਲ ਜਿਨ੍ਹਾਂ ਨੂੰ ਆਪਾਂ ਬੋਲ ਦਿੰਦੇ ਹਾਂ ਗਾਂਵਾਂ ਮੱਝਾਂ ਹੋ ਗਈਆਂ ਇਹ ਸਾਰੇ ਹੀ ਕੀ ਆ ਮੇਰੇ ਏਰੀਆ ਦੇ ਵਿੱਚ ਪਾਏ ਜਾਂਦੇ ਆ